ਮੈਂ ਆਪਣੇ ਜੀਵਨ ਵਿੱਚ ਬਹੁਤ ਹੀ ਚੁਣੌਤੀਪੂਰਨ ਟਰਾਇਲਾਂ 'ਤੇ ਗਿਆ ਹਾਂ ਉਹਨਾਂ 'ਚੋਂ ਇੱਕ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕਲਾਸ ਦਸਵੀਂ ਵਿੱਚ ਪੜ੍ਹਦਾ ਸੀ ਜਦੋਂ ਮੈਂ ਆਪਣੇ ਇੱਕ ਦੋਸਤ ਨਾਲ ਸਾਈਕਲ ਦੇ ਉੱਤੇ ਆਪਣੇ ਘਰ ਤੋਂ ਰਾੜਾ ਸਾਹਿਬ ਜਾਣ ਤੱਕ ਦਾ ਸਫਰ ਤੈਅ ਕਰਨਾ ਸੋਚਿਆ ਸੀ ਸੋ ਐਤਵਾਰ ਵਾਲੇ ਦਿਨ ਅਸੀਂ ਸਵੇਰੇ ਛੇ ਵੱਜ ਕੇ ਦਸ ਮਿੰਟ 'ਤੇ ਘਰੋਂ ਨਿਕਲੇ ਸਾਈਕਲ 'ਤੇ ਅਤੇ ਸਾਈਕਲਿੰਗ ਕਰਦੇ ਹੋਏ ਅਸੀਂ ਰਾੜਾ ਸਾਹਿਬ ਵੱਲ ਨੂੰ ਰਵਾਨਾ ਹੋ ਗਏ ਤਿੰਨ ਚਾਰ ਕਿਲੋਮੀਟਰ ਜਾਣ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਥੱਕ ਗਏ ਤਾਂ ਕਿ ਅਸੀਂ ਸਾਈਕਲ ਰੋਕ ਕੇ ਪਾਣੀ ਵਗੈਰਾ ਪੀਤਾ ਅਤੇ ਫਿਰ ਦੁਬਾਰਾ ਚਾਰਜ ਹੋ ਕੇ ਅਸੀਂ ਆਪਣੇ ਰੂਟ ਵੱਲ ਰਵਾਨਾ ਹੋ ਗਏ ਸ਼ਾਂਤ ਸੱਤ ਵੱਜ ਕੇ ਦਸ ਮਿੰਟ ਤੱਕ ਅਸੀਂ ਰਾੜਾ ਸਾਹਿਬ ਪਹੁੰਚ ਗਏ ਉੱਥੇ ਅਸੀਂ ਮੱਥਾ ਟੇਕਿਆ ਅਤੇ ਲੰਗਰ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਦੋ ਕੁ ਘੰਟੇ ਉੱਥੇ ਬਤੀਤ ਕਰਨ ਤੋਂ ਬਾਅਦ ਅਸੀਂ ਆਪਣੇ ਘਰ ਵੱਲ ਕੂਚ ਕਰਨੀ ਸ਼ੁਰੂ ਕੀਤੀ ਘਰ ਵੱਲ ਕੂਚ ਕਰਦਿਆਂ ਨਹਿਰ ਨਾਲ ਲੱਗਦੀ ਰੋਡ 'ਤੇ ਅਸੀਂ ਆ ਰਹੇ ਸਨ ਤਾਂ ਉੱਥੇ ਇੱਕ ਇੱਕ ਅਚਾਨਕ ਸਾਡੇ ਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਜੋ ਕਿ ਅਸੀਂ ਬਹੁਤ ਡਰ ਗਏ ਸਨ ਕਿਉਂਕਿ ਉਸ ਰੋਡ ਉੱਤੇ ਕੋਈ ਸਾਈਕਲ ਪੈਂਚਰ ਵਾਲੀ ਦੁਕਾਨ ਵੀ ਨਹੀਂ ਸੀ ਫਿਰ ਅਸੀਂ ਗੂਗਲ ਮੈਪ ਦੇ ਸਹਿਯੋਗ ਨਾਲ ਪੈਂਚਰ ਵਾਲੇ ਦੀ ਦੁਕਾਨ ਦਾ ਪਤਾ ਕੀਤਾ ਜੋ ਕਿ ਅੱਠ ਕਿਲੋਮੀਟਰ ਰੋਡ ਤੋਂ ਅੱਗੇ ਜਾ ਕੇ ਸੀ ਸੋ ਇਸ ਲਈ ਅਸੀਂ ਰੋੜ੍ਹ ਕੇ ਸਾਇਕਲ ਉਨੇ ਕਿਲੋਮੀਟਰ ਤੱਕ ਲੈ ਕੇ ਗਏ ਤਾਂ ਅਸੀਂ ਘੰਟੇ ਕੁ ਤੱਕ ਉੱਥੇ ਪਹੁੰਚ ਗਏ ਉੱਥੇ ਪਹੁੰਚਣ ਤੋਂ ਬਾਅਦ ਅਸੀਂ ਸਾਈਕਲ ਨੂੰ ਪੈਂਚਰ ਲਵਾਇਆ ਅਤੇ ਅਸੀਂ ਬਹੁਤ ਹੀ ਖੁਸ਼ ਹੋਏ ਉਸ ਤੋਂ ਬਾਅਦ ਅਸੀਂ ਘਰ ਲਈ ਰਵਾਨਾ ਹੋਏ ਤਾਂ ਦੋ ਘੰਟੇ ਤੱਕ ਅਸੀਂ ਆਪਣੇ ਘਰ ਪਹੁੰਚ ਗਏ ਇਹ ਮੇਰਾ ਸਭ ਤੋਂ ਚੁਣੌਤੀਪੂਰਨ ਟਰੈਲ ਜਾਂ ਟਰੈਕ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਸਾਡਾ ਕੋਈ ਸਾਥੀ ਜਾਂ ਕੋਈ ਉਹੋ ਜਿਹਾ ਬੰਦਾ ਨਹੀਂ ਸੀ ਜੋ ਕਿ ਮਦਦ ਕਰ ਸਕੇ ਸੋ ਇਸ ਲਈ ਮੈਂ ਆਪਣੇ ਚੁਣੌਤੀਪੂਰਨ ਟ੍ਰਾਇਲ ਜਾਂ ਰੂਟ ਇਸ ਨੂੰ ਕਹਿ ਕਹਿ ਸਕਦਾ ਹਾਂ